ਨਹੀਂ ਮੈਂ ਆਪਣੇ ਪ ਪਟਿਆਲਾ ਜ਼ਿਲ੍ਹੇ ਦੇ ਐੱਮ ਐੱਲ ਏ ਨੂੰ ਕਦੇ ਵੀ ਨਹੀਂ ਮਿਲੀ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਪਰੰਤੂ ਮੈਨੂੰ ਉਨ੍ਹਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਹੈ ਸਾਡੇ ਤ ਪਟਿਆਲਾ ਸ਼ਹਿਰ ਦੇ ਐੱਮ ਐੱਲ ਏ ਅਜੀਤਪਾਲ ਸਿੰਘ ਕੋਹਲੀ ਜੋ ਕਿ ਦੋ ਹਜ਼ਾਰ ਬਾਈ ਵਿੱਚ ਇਲੈਕਸ਼ਨਾਂ ਦੇ ਨਾਲ ਜਿੱਤੇ ਹਨ ਉਹ ਇੱਕ ਸੰਸਥਾਪਕ ਮੈਂਬਰ ਸਨ ਅਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦਾ ਹਿੱਸਾ ਬਣਨਾ ਜਾਰੀ ਰੱਖਦੇ ਹਨ ਜੋ ਕਿ ਗਰੀਬਾਂ ਦੀ ਮਦਦ ਕਰਨ ਅਤੇ ਵੱਖ ਵੱਖ ਭਲਾਈ ਪਹਿਲਕਦਮੀਆਂ ਰਾਹੀਂ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇੱਕ ਪਹਿਲਕਦਮੀ ਹੈ ਉਹ ਲੋਟਰੀ ਕਲੱਬ ਦੇ ਮੈਂਬਰ ਵੀ ਹਨ ਉਸ ਉਨ੍ਹਾਂ ਨੇ ਦੋ ਹਜ਼ਾਰ ਵੀਹ ਕੋਵਿਡ ਨਾਈਨਟੀਨ ਲੋਕਡਾਊਨ ਦੌਰਾਨ ਪਟਿਆਲਾ ਦੇ ਆਦਿਵਾਸੀ ਭਾਈਚਾਰਿਆਂ ਲਈ ਸੇਵਾ ਲਈ ਉਜਾਗਰ ਸਨ ਉਹ ਸਾਡੇ ਪਟਿਆਲਾ ਵਿੱਚ ਰਹਿਣ ਵਾਲੇ ਬੱਚਿਆਂ ਦੇ ਲਈ ਇੱਕ ਬਹੁਤ ਹੀ ਵਧੀਆ ਕੰਮ ਕਰਦੇ ਹਨ ਉਨ੍ਹਾਂ ਨੇ ਟਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਅਠਾਰ੍ਹਾਂ ਸਾਲ ਤੋਂ ਛੋਟੀ ਉਮਰ ਦੇ ਬੱਚੇ ਵਾਹਨ ਨਹੀਂ ਚਲਾਉਣਗੇ ਇਸ ਨਾਲ ਪੰਜਾਬ ਦੇ ਵਿੱਚ ਸਾਡੇ ਰਹਿਣ ਵਾਲੇ ਪਟਿਆਲਾ ਡਿਸਟ੍ਰਿਕ ਦੇ ਵਿੱਚ ਕਰਾਈਮ ਰੇਟ ਬਹੁਤ ਘੱਟ ਗਿਆ ਹੈ